ਖੇਡਾਂ ਖੇਡਣ ਨਾਲ਼ ਬੰਦੇ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਨਸ਼ਿਆਂ ਤੋਂ ਆਦੀਆਂ ਤੋਂ ਬਹੁਤ ਬੰਦਾ ਦੂਰ ਰਹਿੰਦਾ ਹੈ